ਹਾਂਜੀ ਮੈਨੂੰ ਪਾਲਤੂ ਪਸ਼ੂ ਪਸੰਦ ਹਨ ਅਸੀਂ ਆਪਣੇ ਘਰ ਵਿੱਚ ਮੱਝ ਗਾਂ ਕੁੱਤਾ ਬੱਕਰੀ ਆਦਿ ਰੱਖੇ ਹੋਏ ਹਨ ਮੱਝ ਜੋ ਕਿ ਸਾਨੂੰ ਬਹੁਤ ਫਾਇਦ ਮੱਝ ਦੇ ਬਹੁਤ ਜ਼ਿਆਦਾ ਫਾਇਦੇ ਹਨ ਫਸਟਲੀ ਮੱਝ ਦੇ ਦੁੱਧ ਤੋਂ ਅਸੀਂ ਪਨੀਰ ਆਦਿ ਤਿਆਰ ਕਰਕੇ ਉਸਨੂੰ ਵੇਚ ਵੀ ਸਕਦੇ ਹਾਂ ਅਤੇ ਅਸੀਂ ਖਾ ਵੀ ਸਕਦੇ ਹਾਂ ਜਿਸ ਤੋਂ ਆਪਾਂ ਪਿਓਰ ਘੇ ਪਿਓਰ ਦੇਸੀ ਘਿਓ ਵੀ ਤਿਆਰ ਕਰ ਸਕਦੇ ਹਾਂ ਅਤੇ ਉਸਨੂੰ ਇਨ੍ਹਾਂ ਮਹਿੰਗਾ ਵੇਚ ਸਕਦੇ ਹਾਂ ਮੱਝ ਦਾ ਦੁੱਧ ਅਸੀਂ ਅਸੀਂ ਡਾਇਰੀ ਵਿੱਚ ਪਾ ਕੇ ਪੈਸੇ ਵੀ ਰੁਜ਼ਗਾਰ ਬਣਾ ਸਕਦੇ ਹਾਂ ਅਤੇ ਪੈਸੇ ਕਮਾ ਸਕਦੇ ਹਾਂ ਅਤੇ ਮੱਝਾਂ ਨੂੰ ਅਸੀਂ ਛੋਟੀਆਂ ਕੱਟੀਆਂ ਵੱਛੀਆਂ ਨੂੰ ਅਸੀਂ ਪਾਲ਼ ਪਾਲ਼ ਕੇ ਵੱਡੇ ਕਰਕੇ ਅਸੀਂ ਇਹਨਾਂ ਨੂੰ ਮੰਡੀਆਂ ਵਿੱਚ ਵੇਚ ਵੀ ਸਕਦੇ ਹਨ ਜੋ ਕਿ ਵਧੀਆ ਭਾਅ ਵਿੱਚ ਵਿਕ ਜਾਂਦੀਆਂ ਹਨ ਅਤੇ ਜਿਸ ਨਾਲ਼ ਅਸੀਂ ਬਿਜ਼ਨਸ ਕਰ ਸਕਦੇ ਹਾਂ ਮੱਝਾਂ ਦਾ ਅਤੇ ਗਾਂ ਜਿਸ ਤੋਂ ਅਸੀਂ ਗਾਂ ਦਾ ਦੁੱਧ ਪਤਲਾ ਹੁੰਦਾ ਹੈ ਜੇ ਜੋ ਅਸੀਂ ਪੀ ਸਕਦੇ ਹਾਂ ਅਤੇ ਛੋਟੇ ਬੱਚੇ ਨੂੰ ਜ਼ਿਆਦਾਤਰ ਗਾਂ ਦਾ ਦੁੱਧ ਹੀ ਪਿਲਾਇਆ ਜਾਂਦਾ ਹੈ ਕਿਉਂਕਿ ਇਹ ਸਾਡੀ ਸਿਹਤ ਲਈ ਬਹੁਤ ਵਧੀਆ ਹੈ ਗਾਂ ਦਾ ਦੁੱਧ ਗਾਂ ਦੇ ਦੁੱਧ ਤੋਂ ਅਸੀਂ ਪਨੀਰ ਆਦਿ ਵੀ ਤਿਆਰ ਕਰ ਸਕਦੇ ਹਾਂ ਕੁੱਤਾ ਜੋ ਕੁੱਤਾ ਕੁੱਤਾ ਅਸੀਂ ਵਧੀਆ ਕੁਆਲਿਟੀ ਦਾ ਰੱਖ ਕੇ ਅਸੀਂ ਉਸਨੂੰ ਵਧੀਆ ਵੇਚ ਵੀ ਸਕਦੇ ਹਾਂ ਮਹਿੰਗੇ ਮਹਿੰਗੇ ਵੇਚ ਸਕਦੇ ਹਾਂ ਬੱਕਰੀ ਜਦੋਂ ਸਾਡੇ ਸੈੱਲ ਘੱਟਦੇ ਹਨ ਤਾਂ ਸਾਨੂੰ ਬੱਕਰੀ ਦਾ ਦੁੱਧ ਪੀਣ ਲਈ ਕਿਹਾ ਜਾਂਦਾ ਹੈ ਤਾਂ ਅਸੀਂ ਬੱਕਰੀ ਦਾ ਦੁੱਧ ਪੀ ਸਕਦੇ ਹਾਂ ਜਿਸ ਨਾਲ ਸਾਡੇ ਸ ਸੈੱਲ ਵੀ ਠੀਕ ਰਹਿ ਸਕਣ ਅਤੇ ਘੋੜੇ ਜੋ ਕਿ ਅਸੀਂ ਆਪਣੇ ਸ਼ੌਂਕ ਲਈ ਰੱਖਦੇ ਹਾਂ ਧੰਨ